ਪਸ਼ੂ ਪਾਲਣ ਵਾਲੇ ਕਾਰੋਬਾਰ ਵਿੱਚ ਮੀਂਹ ਟੰਡੇ ਦੁੱਧ ਤੇ ਉੱਨ ਦੇ ਨਾਲ ਕੁਛ ਹੋਰ ਵਾਧੂ ਉਤਪਾਦ ਵੀ ਹਨ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ ਅਤੇ ਬੇਚ ਸਕਦੇ ਹੋ ਇਹ ਉਤਪਾਦ ਪਸ਼ੂ ਪਾਲਣ ਦੇ ਰੂਪ ਵਿੱਚ ਖੇਤੀਬਾੜੀ ਵਿੱਚ ਇਕ ਮਕਸਦ ਦੀ ਤਰ੍ਹਾਂ ਆਮ ਤੌਰ ਤੇ ਪੈਦਾ ਕੀਤੇ ਜਾਂਦੇ ਹਨ ਤੇ ਵਪਾਰਕ ਉਪਦੇਸ਼ਾਂ ਲਈ ਵਰਤੇ ਜਾਂਦੇ ਹਨ ਆਓ ਕੁਝ ਵਿਸਤਾਰ ਨਾਲ ਦੇਖੀਏ ਚਮੜਾ ਚਮੜਾ ਜੋ ਕਿ ਗਾਵਾਂ ਬੱਕਰੀਆਂ ਤੇ ਭੇਡਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਉਹ ਵੀ ਇੱਕ ਮਹੱਤਵਪੂਰਨ ਉਤਪਾਦ ਹੈ ਚਮੜਾ ਜੁੱਤੇ ਬੈਗ ਜੈਕਟ ਅਤੇ ਹੋਰ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ ਇਸ ਨੂੰ ਤਿਆਰ ਕਰਨ ਲਈ ਕੁਝ ਪ੍ਰੋਸੈਸਿੰਗ ਦੀ ਲੋੜ ਹੁੰਦੀ ਹੈ ਪਰ ਇਸ ਦਾ ਵਿਭਾਗ ਸਿੱਧਾ ਲਾਭਕਾਰੀ ਹੋ ਸਕਦਾ ਹੈ ਗੋਭੀ ਜਾਂ ਪਸ਼ੂ ਮਲ ਪਸ਼ੂ ਦੇ ਮਲ ਖੇਤੀ ਲਈ ਇਕ ਮਹੱਤਵਪੂਰਨ ਖਾਦ ਹੈ ਇਹ ਕਾਰਬਾਰ ਇਹ ਕਾਰਬਨ ਤੇ ਨਾਈਟਰੋਜਨ ਦੇ ਸਮਰਥਾਂ ਨਾਲ ਪੌਦਿਆਂ ਨੂੰ ਖਾਦ ਦੇਣ ਲਈ ਬਹੁਤ ਫਾਇਦੇਮੰਦ ਹੈ ਇਸ ਨੂੰ ਕੁਝ ਖੇਤੀਬਾੜੀ ਕੰਪਨੀਆਂ ਤੇ ਕਿਸਾਨ ਖਰੀਦ ਦੇ ਹਨ ਇਸ ਲਈ ਇਸ ਨੂੰ ਵੇਚਣਾ ਇੱਕ ਲਾਭਕਾਰੀ ਵਪਾਰ ਬਣ ਸਕਦਾ ਹੈ ਭੇਡਾਂ ਖਰਗੋਸ਼ਾਂ ਤੇ ਕੁਕਰਾ ਤੋ ਉੱਨ ਫਰ ਜਾ ਵਲ ਨੂੰ ਉਤਪਾਦਿਤ ਕੀਤਾ ਜਾ ਸਕਦਾ ਹੈ ਕੁਝ ਖੇਤੀਬਾੜੀ ਕਾਰੋਬਾਰੀ ਵਿੱਚ ਪਸ਼ੂਆਂ ਦਾ ਲਹੂ ਵੀ ਪ੍ਰੋਡਕਟ ਪਰੋਡਕਟ ਹੁੰਦਾ ਹੈ ਜੋ ਖੇਤੀ ਵਿੱਚ ਫਰਟੀਲਾਈਜ਼ਰ ਜਾਂ ਖਾਦ ਦੀ ਤਰ੍ਹਾਂ ਵਰਤਿਆ ਜਾਂਦਾ ਹੈ ਪਸ਼ੂ ਪਾਲਣ ਨਾਲ ਸਿੱਧਾ ਜੁੜੇ ਹੋਏ ਜੀਵਾਨੂ ਜਾਂ ਬੈਕਟੀਰੀਆ ਕਈ ਜਾਂ ਹੋਰ ਪਸ਼ੂਆਂ ਦੀ ਸਿਹਤ ਸੇਵਾਵਾਂ ਵਿੱਚ ਵਰਤੇ ਜਾਂਦੇ ਹਨ ਪਸ਼ੂਆਂ ਦੀਆਂ ਹੱਡੀਆਂ ਤੇ ਦਾਤਾਂ ਤੋਂ ਕੁਝ ਉਤਪਾਦ ਪ੍ਰਾਪਤ ਕੀਤੇ ਜਾਂਦੇ ਹਨ ਜਿਵੇਂ ਕਿ ਕਮਰਾ ਗਹਿਣਿਆਂ ਜਾਂ ਖੇਤੀ ਲਈ ਜੈਵਿਕ ਖਾਦ